ਖਾਣਾ ਬਣਾਉਣ ਦੇ ਤਰੀਕੇ ਦੀ ਗੱਲ ਕਰੀਏ ਤਾਂ ਹ ਯੂਟੀਊਬ ਗੂਗਲ ਜਾਂ ਇੰਟਰਨੈਟ 'ਤੇ ਹਰੇਕ ਕੋਈ ਆਪਣੇ ਆਪਣੇ ਤਰੀਕੇ ਨਾਲ ਰੈਸਿਪੀ ਦੇ ਸਕਦਾ ਹੈ ਪਰ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਆਪਣਾ ਖਾਣਾ ਬਣਾਉਣ ਦਾ ਤਰੀਕਾ ਆਪਣੀ ਦਾਦੀ ਤੋਂ ਦਾਦੀ ਤੋਂ ਬਾਅਦ ਆਪਣੀ ਮਾਤਾ ਤੋਂ ਹੀ ਸਿੱਖਿਆ ਉਹਨਾਂ ਦੇ ਹੱਥਾਂ ਦਾ ਸਵਾਦ ਮੈਂ ਆਪਣੇ ਹੀ ਖਾਣੇ ਦੇ ਵਿੱਚ ਲਿਆਉਣਾ ਸਿੱਖਿਆ ਹੈ ਅਤੇ ਹੁਣ ਮੇਰੇ ਵਿਆਹ ਤੋਂ ਬਾਅਦ ਮੈਂ ਆਪਣੇ ਨਵੇਂ ਘਰ ਦੇ ਵਿੱਚ ਖਾਣਾ ਬਣਾਉਂਦੀ ਹਾਂ ਪਰ ਉਹਨਾਂ ਦਾ ਸਵਾਦ ਅਲੱਗ ਹੁੰਦਾ ਹੈ ਸੋ ਮੈਂ ਉਹਨਾਂ ਦੇ ਸਵਾਦ ਦੇ ਅਨੁਸਾਰ ਹੀ ਉਹਨਾਂ ਲਈ ਖਾਣਾ ਬਣਾਉਂਦੀ ਹਾਂ ਰੈਸੀਪੀ ਮੈਂ ਆਪਣੀ ਮੋਸਟਲੀ ਆਪਣੀ ਮਾਤਾ ਤੋਂ ਹੀ ਸਿੱਖਿਆ ਹੈ ਉਹਨਾਂ ਦੇ ਹੱਥ ਦਾ ਸਵਾਦ ਬਹੁਤ ਹੀ ਅਲੱਗ ਹੈ ਉਹੀ ਹੁਣ ਮੈਂ ਸਵਾਦ ਆਪਣੇ ਨਵੀਂ ਘਰ ਦੇ ਵਿੱਚ ਵੀ ਲਿਆ ਰਹੀ ਹਾਂ ਰੈਸਪੀ ਹਾ ਇੰਟਰਨੈਟ 'ਤੇ ਮੌਜੂਦ ਹੈ ਗੂਗਲ 'ਤੇ ਵੀ ਹਰੇਕ ਆਪਣੇ ਆਪਣੇ ਹੀ ਖਿਆਲ ਨਾਲ ਆਪਣੇ ਆਪਣੇ ਤਰੀਕੇ ਨਾਲ ਰੈਸਿਪੀ ਅਪਲੋਡ ਕਰ ਦਿੰਦਾ ਹੈ ਜਿਸ ਨਾਲ ਕਾਫੀ ਸਾਰੇ ਲੋਕ ਦੇਖ ਕੇ ਆਪਣੇ ਹੀ ਹਿਸਾਬ ਨਾਲ ਬਣਾਉਂਦੇ ਹਾਂ ਪਰ ਆਪਾਂ ਆਪਣੇ ਘਰਦਿਆਂ ਤੋਂ ਹੀ ਜ਼ਿਆਦਾ ਵਧੀਆ ਖਾਣਾ ਬਣਾਉਣਾ ਸਿੱਖ ਸਕਦੇ ਹਾਂ ਜਿਸ ਨਾਲ ਅਸੀਂ ਉਹਨਾਂ ਦੇ ਸਾਹਮਣੇ ਰਹਿ ਕੇ ਹੀ ਇਹ ਕਿਵੇਂ ਚੀਜ਼ ਕਿਵੇਂ ਕਰਨੀ ਹੈ ਸਭ ਕੁਝ ਸਾਨੂੰ ਪਤਾ ਲੱਗ ਜਾਂਦਾ ਹੈ ਅਤੇ ਅਸੀਂ ਉਹਨਾਂ ਦੇ ਹਿਸਾਬ ਨਾਲ ਹੀ ਆਪਾਂ ਖਾਣਾ ਬਣਾਉਂਦੇ ਹਾਂ